ਭੰਗੜਾ ਇੱਕ ਪ੍ਰਸਿੱਧ ਪੰਜਾਬੀ ਲੋਕ ਨਾਚ ਹੈ ਇਹ ਸਾਰੇ ਪੰਜਾਬ ਵਿੱਚ ਪ੍ਰਸਿੱਧ ਹੈ ਭੰਗੜਾ ਪੰਜਾਬ ਦੇ ਦੋ ਪ੍ਰਮੁੱਖ ਲੋਕ ਨਾਚਾਂ ਵਿੱਚੋਂ ਇੱਕ ਹੈ ਦੂਜਾ ਪ੍ਰਮੁੱਖ ਨਾਚ ਗਿੱਧਾ ਹੈ ਆਮ ਤੌਰ 'ਤੇ ਭੰਗੜਾ ਨੌਜਵਾਨ ਗੱਭਰੂ ਕਰਦੇ ਹਨ ਅਤੇ ਗਿੱਧਾ ਮੁਟਿਆਰਾਂ ਜਾ ਲੜਕੀਆਂ ਪਾਉਂਦੀਆਂ ਹਨ ਭੰਗੜਾ ਹਰ ਇੱਕ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਜਿਵੇਂ ਮੇਲੇ ਤਿਹਾ ਤਿਉਹਾਰ ਵਿਆਹ ਅਤੇ ਕਣਕ ਦੀ ਵਾਢੀ ਸਮੇਂ ਭਾਵ ਵਿਸਾਖੀ ਸਮੇਂ ਪਾਇਆ ਜਾਂਦਾ ਹੈ ਇਹ ਲੋਕ ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਵਾਂਗ ਹੀ ਪ੍ਰਾਚੀਨ ਹੈ ਭੰਗੜਾ ਪਹਿਲਾਂ ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਖੂਪੁਰੇ ਪੱਛਮੀ ਗੁਜਰਾਤ ਅਤੇ ਸਿਆਲਕੋਟ ਵਿੱਚ ਜ਼ਿਆਦਾ ਪ੍ਰਚਲਿਤ ਸੀ ਪਹਿਲਾਂ ਇਸ ਦਾ ਸੰਬੰਧ ਵਿਸਾਖੀ ਸਮੇਂ ਕਣਕ ਦੀ ਵਾਢੀ ਨਾਲ ਸੀ ਉਸ ਸਮੇਂ ਲੋਕ ਖੁਸ਼ੀ ਵਿੱਚ ਭੰਗੜਾ ਪਾਉਂਦੇ ਹਨ ਭੰਗੜਾ ਭੰਗੜੇ ਵਿੱਚ ਪੇਂਡੂ ਸਾਜਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਢੋਲ ਭੰਗੜੇ ਦਾ ਪ੍ਰਮੁੱਖ ਸਾਜ ਹੈ ਭੰਗੜੇ ਦੇ ਕੁਝ ਆਮ ਸਟੈਪ ਗਿੱਧਾ ਮਲਵਈ ਗਿੱਧਾ ਕਿੱਕਲੀ ਝੂਮਰ ਸੰਮੀ ਲੁੱਡੀ ਧਮਾਲ ਆਦਿ ਹਨ